ਅੱਜ ਕੱਲ੍ਹ ਵਧੇਰੇ ਲੋਕਾਂ ਤੱਕ ਪਹੁੰਚਣ ਦਾ ਬਹੁਤ ਵਧੀਆ ਤਰੀਕਾ ਜੋ ਹੈ ਉਹ ਸੋਸ਼ਲ ਮੀਡੀਆ ਹੈ ਵਟਸਅਪ ਫੇਸਬੁੱਕ ਅਤੇ ਇੰਸਟਾਗਰਾਮ ਦੁਆਰਾ ਬਹੁਤੇ ਲੋਕਾਂ ਤੱਕ ਅਸੀਂ ਆਪਣੇ ਪ੍ਰੋਡਕਟਸ ਦੀ ਐਡਵਰਟਾਈਜਮੈਂਟ ਕਰ ਸਕਦੇ ਹਾਂ